ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਅੱਜ ਤੱਕ ਦੀ ਲਾਈਫ਼ 'ਚ ਤਾਂ ਬਹੁਤ ਸਾਰੇ ਇਦਾਂ ਦੇ ਸਿੰਗਰ ਹੈ ਜਿਹਨਾਂ ਨੂੰ ਮੈਂ ਪ੍ਰਸਨਲੀ ਮਿਲ ਚੁੱਕੀ ਹਾਂ ਇਨ੍ਹਾਂ ਦੇ ਵਿੱਚ ਬੱਬੂ ਮਾਨ ਜੀ ਉਸਤਾਦ ਬੱਬੂ ਮਾਨ ਜੀ ਸਭ ਤੋਂ ਪਹਿਲਾਂ ਆਉਂਦੇ ਨੇ ਸਤਿੰਦਰ ਸਰਤਾਜ ਉਨੀਂ ਹੋ ਗਏ ਹੋਰ ਵੀ ਬਹੁਤ ਸਾਰੇ ਸਿੰਗਰ ਹੈ ਜਿੰਨ੍ਹਾਂ ਨੂੰ ਅਸੀਂ ਮਿਲ ਚੁੱਕੇ ਆ ਐਂਮੀ ਵਿਰਕ ਉਨੀਂ ਇਹ ਸਾਰਿਆਂ ਨੂੰ ਅਸੀਂ ਮਿਲਦੇ ਹੀ ਰਹਿੰਦੇ ਹੈ ਕਿਉਂਕਿ ਮਿਊਜ਼ਿਕ ਦਾ ਕੰਮ ਹੈ ਮਿਊਜ਼ਿਕ ਦੇ ਕੰਮ 'ਚ ਇੱਕ ਦੂਜੇ ਨਾਲ਼ ਮਿਲਣਾ ਵਰਤਣਾ ਹੁੰਦਾ ਹੀ ਰਹਿੰਦਾ ਹੈ ਲਾਈਫ਼ ਤੋਂ ਇਹ ਹੀ ਕੁੱਝ ਸਿੱਖਿਆ ਜਿਵੇਂ ਸਤਿੰਦਰ ਸਰਤਾਜ ਹੋ ਗਿਆ ਅਤੇ ਉਹ ਬਹੁਤ ਡਾਊਨ ਟੂ ਅਰਥ ਬੰਦੇ ਹੈ ਉਹ ਜ਼ਿਆਦਾਤਰ ਸੂਫ਼ੀ ਸੂਫ਼ੀਜਮ ਦੇ ਗਾਣੇ ਜ਼ਿਆਦਾ ਗਾਉਂਦੇ ਅਤੇ ਉਹਨਾਂ ਦਾ ਜਿਹੜਾ ਇੱਕ ਔਰਾ ਏ ਉਹ ਰੂਹਾਨੀਅਤ ਆਲਾ ਹੈ ਮਤਲਬ ਉਹ ਰੂਹਾਨੀਅਤ ਆਲੇ ਗੀਤ ਗਉਂਦੇ ਜਿਹਦੇ ਨਾਲ਼ ਸੁਣ ਕੇ ਬੰਦੇ ਦਾ ਦਿਲ ਦਿਲ ਹੈ ਔਰ ਆਤਮ ਏ ਉਹ ਪ੍ਰਮਾਤਮਾ ਨਾਲ਼ ਜੁੜ ਇੱਕ ਤਰ੍ਹਾਂ ਕਨੈਕਟ ਹੋ ਜਾਂਦੀ ਹੈ ਅਤੇ ਬੱਬੂ ਉਹਨਾਂ ਨਾਲ਼ ਮਿਲਕੇ ਸਾਨੂੰ ਦੂਜਿਆਂ ਦੀ ਸੇਵਾ ਕਰਨੀ ਅਤੇ ਦੂਜੇ ਬੰਦਿਆਂ ਦੀ ਆਪਾਂ ਨੇ ਕਿਵੇਂ ਹੈਲਪ ਕਰਨੀ ਹੈ ਡਾਊ ਐਂਨੀ ਐਂਨੀ ਵੱਡੀ ਫੇਮ ਲੈ ਕੇ ਵੀ ਕਿਵੇਂ ਆਪਾਂ ਡਾਊਂਨ ਟੂ ਅਰਥ ਰਹਿਣਾ ਹੈ ਉਹ ਸਾਰਾ ਕੁਝ ਬੱਬੂ ਮਾਨ ਤੋਂ ਸਿੱਖਿਆ ਹੈ ਅਤੇ ਉਹਨਾਂ ਦੇ ਵਿੱਚ ਬਿਲਕੁੱਲ ਵੀ ਕੋਈ ਐਂ ਨੀ ਹੈਗਾ ਵੀ ਅਸੀਂ ਬਹੁਤ ਵੱਡੇ ਕਲਾਕਾਰ ਹਾਂ ਜਾਂ ਜੋ ਵੀ ਹੈ ਉਹ ਇੱਕ ਆਮ ਇਨਸਾਨਾਂ ਵਾਂਗੂ ਰਹਿੰਦੇ ਹੈ ਹਾਂਜੀ ਹਾਂਜੀ ਸਮਝ ਸਕਦੇ ਹੈ ਹਾਂਜੀ ਹਾਂਜੀ ਬਿਲਕੁੱਲ ਬਿਲਕੁੱਲ ਅਸੀਂ ਤੁਹਾਡੀ ਕਿਵੇਂ ਹੈਲਪ ਕਰ ਸਕਦੇ ਆ ਹਾਂਜੀ ਹਾਂਜੀ ਅਸੀਂ ਮੈਂ ਤੁਹਾਨੂੰ ਵੱਅਟਸਐਪ ਕਰਦਾਂਗੀ ਤੁਸੀਂ ਜਦੋਂ ਮਰਜ਼ੀ ਆ ਜੇਓ ਓਕੇ ਜੀ ਓਕੇ ਥੈਂਕ ਯੂ